ਭਾਰਤੀ ਸਿੱਖਿਆ ਪ੍ਰਣਾਲੀ ਦੀ ਅਗਰ ਆਪਾਂ ਗੱਲ ਕਰ ਲਈਏ ਵਰਤਮਾਨ ਸਮੇਂ ਵਿੱਚ ਤਾਂ ਇੱਹਦੇ ਵਿੱਚ ਕਾਫੀ ਸ ਸੁਧਾਰ ਦੇਖਿਆ ਜਾ ਰਿਹਾ ਇੱਸਦੀ ਗੁਣਵੱਤਾ ਵਿੱਚ ਅਤੇ ਇੱਸਦੇ ਮਿਆਰ ਵਿੱਚ ਕਾਫੀ ਜ਼ਿਆਦਾ ਸੁਧਾਰ ਹੋਇਆ ਹੋਇਆ ਹੈ ਅਤੇ ਇਹਦੇ ਵਿੱਚ ਜੋ ਅਹਿਮ ਭੂਮਿਕਾ ਨਿਭਾਈ ਹੈ ਉਹ ਨਿਭਾਈ ਹੈ ਸਰਵ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਸਿੱਖਿਆ ਨੀਤੀ ਨੇ ਜਿਹਦੇ ਨਾਲ ਅਸੀਂ ਪੁਰਾਣੇ ਭਾਰਤ ਦੀ ਗੱਲ ਕਰੀਏ ਤਾਂ ਅ ਅਗਰ ਘ ਵਰਤਮਾਨ ਭਾਰਤ ਨੂੰ ਦੇਖੀਏ ਤਾਂ ਇਹਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਇਹਦੇ ਵਿੱਚ ਕਾਫੀ ਸਾਰਾ ਸੁਧਾਰ ਹੋਇਆ ਹੋਇਆ ਹੈ ਦੂਸਰਾ ਅਗਰ ਇਹਦੇ ਵਿੱਚ ਅਸੀਂ ਚੁਣੌਤੀਆਂ ਦੀ ਗੱਲ ਕਰੀਏ ਤਾਂ ਵੀ ਕਿਤੇ ਨਾ ਕਿਤੇ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਕਈ ਖੇਤਰਾਂ ਵਿੱਚ ਚੁਣੌਤੀਆਂ ਸਾਹਮਣਾ ਕਰਨੀਆਂ ਪੈ ਰਹੀਆਂ ਹਨ ਜਿਹਦੇ ਵਿੱਚ ਪ੍ਰਮੁੱਖ ਹੁੰਦਾ ਹੈ ਪਿੰਡਾਂ ਦੀ ਪਿੰਡਾਂ ਦੇ ਖੇਤਰ